ਰਾਤ ਦੇ ਸਮੇਂ ਤਾਂ ਪੰਛੀ ਵੇਖਣ ਨੂੰ ਬਹੁਤ ਹੀ ਘੱਟ ਮਿਲਦੇ ਹਨ ਕਿਉਂਕਿ ਉਹ ਸ਼ਾਮ ਦੇ ਟੈਮ ਤਾਂ ਪੰਛੀ ਆਪਣੇ ਆਪਣੇ ਆਲ੍ਹਣਿਆਂ 'ਚ ਆਪਣੇ ਆਪਣੇ ਪਰਤ ਜਾਂਦੇ ਨੇ ਵਾਪਸ ਕਿਉਂਕਿ ਸ਼ਾਮ ਦੇ ਟੈਮ ਪੰਛੀਆਂ ਦੀਆਂ ਉਡਾਰਾਂ ਵੇਖਣ ਨੂੰ ਮਿਲਦੀਆਂ ਨੇ ਉਹ ਇੱਕ ਕਤਾਰ 'ਚ ਹੀ ਆਪਸ 'ਚ ਵੀ ਜਾਂਦੇ ਨੇ ਵੀ ਰਾਤ ਨੂੰ ਤਾਂ ਪੰਛੀ ਦੇਖਣ ਨੂੰ ਸਿਰਫ ਇੱਕ ਉੱਲੂ ਹੀ ਹੁੰਦਾ ਹੈ ਕਿਉਂਕਿ ਉਸ ਦਾ ਰਾਤ ਦਾ ਟੈਮ ਹੁੰਦਾ ਹੈ ਅਤੇ ਉਹ ਰਾਤ ਦੇ ਟੈਮ ਜਾਗਦਾ ਹੈ ਕਿਉਂਕਿ ਉਹ ਉਸ ਦੀਆਂ ਉਸਦੀ ਆਵਾਜ਼ ਉਸਦੀਆਂ ਜਿਹੜੀਆਂ ਅੱਖਾਂ ਨੇ ਰਾਤ ਦੇ ਟੈਮ ਐਂ ਜਗਮਗ ਜਗਮਗ ਜੁਗਨੂੰ ਤਰ੍ਹਾਂ ਕਰਦੀਆਂ ਹੈ ਕਿਉਂਕਿ ਦੂਸਰੇ ਪੰਛੀ ਤਾਂ ਵੀ ਸ਼ਾਮ ਦੇ ਟੈਮ ਆਪਣੇ ਆਲ੍ਹਣਿਆਂ 'ਚ ਟੈਮ ਦੇ ਨਾਲ ਜਦੋਂ ਵੀ ਸੂਰਜ ਛੁਪਣ ਤੋਂ ਪਹਿਲੋਂ ਹੀ ਆਪਣੇ ਆਲ੍ਹਣਿਆਂ 'ਚ ਵਾਪਸ ਪਰਤਣਾ ਸ਼ੁਰੂ ਹੋ ਜਾਂਦੇ ਨੇ ਸਿਰਫ ਇੱਕ ਰਾਤ ਦੇ ਟੈਮ ਦੇਖਣ ਨੂੰ ਮਿਲਦਾ ਹੈ ਜਾਂ ਉੱਲੂ ਅਤੇ ਜਾਂ ਜੁਗਨੂੰ ਜਾਂ ਜੁਗਨੂੰ ਹੁੰਦੇ ਨੇ ਜਿਹੜੇ ਰਾਤ ਨੂੰ ਜਗਮਗ ਜਗਮਗ ਕਰਦੇ ਹਨ ਜੁਗਨੂੰਆਂ ਦੀ ਤਾਂ ਇੱਕ ਮਿਸਾਲ ਹੀ ਵੱਖਰੀ ਹੁੰਦੀ ਹੈ ਕਿਉਂਕਿ ਉਹ ਇੱਕ ਬਹੁਤ ਐਂ ਜੱਗਦੇ ਨੇ ਜਿਸ ਤਰ੍ਹਾਂ ਬਲਬ ਆਪਣੇ ਬਲਬ ਜੱਗਦੇ ਹੁੰਦੇ ਨੇ ਹਾਂਜੀ ਹਾਂ ਉਹ ਐਂ ਬਲਬ ਉਹਨਾਂ ਦੀਆਂ ਰੋਸ਼ਨੀ ਐਂ ਹੁੰਦੀ ਹੈ ਜਿਵੇਂ ਆਪਾਂ ਬਲਬ ਨਹੀਂ ਜੱਗਦੇ ਬੁਝਦੇ ਜੱਗਦੇ ਬੁਝਦੇ ਉਸ ਤਰ੍ਹਾਂ ਦੇ ਹੁੰਦੇ ਨੇ ਸਿਰਫ ਇੱਕ ਉੱਲੂ ਹੁੰਦਾ ਹੈ ਇੱਕ ਜੁਗਨੂੰ ਬਾਕੀ ਤਾਂ ਸਭ ਪੰਛੀ ਰਾਤ ਦੇ ਟੈਮ ਨਹੀਂ ਅੱਜ ਤੱਕ ਨਹੀਂ ਦੇਖੇ ਸਿਰਫ ਉੱਲੂ ਅਤੇ ਜੁਗਨੂੰ ਹੀ ਵੇਖੇ ਹਨ ਧੰਨਵਾਦ